ਤੁਸੀਂ ਆਡਰ ਦਿੱਤਾ ਪਰ ਕਿਸੇ ਕਾਰਨ ਇਸਨੂੰ ਵਾਪਸ ਕਰਨਾ ਪਿਆ ਹਾਂਜੀ ਘਰ ਦੇ ਵਿੱਚ ਫੈਮਿਲੀ ਨੇ ਆਡਰ ਬੁੱਕ ਕੀਤਾ ਜੀ ਸਰ ਜੀ ਅਤੇ ਆਡਰ ਜਦੋਂ ਲੈ ਕੇ ਆਇਆ ਠੀਕ ਹੈ ਤਾਂ ਉਹਦੇ ਵਿੱਚ ਥੋੜ੍ਹਾ ਨਮਕ ਵਗੈਰਾ ਥੋੜ੍ਹਾ ਤੇਜ਼ ਸੀ ਤੇਜ਼ ਹੋਣ ਕਾਰਨ ਮੈਨੂੰ ਖਾਣਾ ਠੀਕ ਨਹੀਂ ਲੱਗਿਆ ਅਤੇ ਅਚਨਚੇਤ ਇੱਕ ਫ਼ੋਨ ਆਇਆ ਅਤੇ ਫੈਮਲੀ ਸਮੇਤ ਸਾਨੂੰ ਵਾਪਸ ਜਾਣਾ ਪਿਆ ਵਾਪਸ ਜਾਣ ਤੋਂ ਬਾਅਦ ਮੈਂ ਉਹ ਖਾਣਾ ਵਾਪਸ ਕਰਨਾ ਚਾਹੁੰਦਾ ਸੀ ਅਤੇ ਮੈਨੂੰ ਕੋਂਪਨੀ ਵੱਲੋਂ ਜੋ ਪੈਸੇ ਬਣਦੇ ਸੀ ਉਹ ਵਾਪਸ ਦਿੱਤੇ ਜਾਣ ਠੀਕ ਹੈ ਵਾਪਸ ਦਿੱਤੇ ਜਾਣ ਕਿਉਂਕਿ ਖਾਣਾ ਜ਼ਿਆਦਾ ਕੁਛ ਟੇਸਟੀ ਨਹੀਂ ਸੀ ਲੱਗਿਆ ਅਤੇ ਘਰ ਵਿੱਚ ਸਾਰੇ ਜਿਹੜੇ ਜਾਣ ਵਾਲੇ ਸੀ ਅਤੇ ਜਿਸ ਕਾਰਨ ਉਹ ਖਾਣਾ ਵੇਸਟ ਹੀ ਹੋ ਜਾਣਾ ਸੀ ਅਤੇ ਮੈਂ ਉਹ ਵਾਪਸ ਕਰ ਦਿੱਤਾ ਵਾਪਸ ਕਰਨ ਕਰਕੇ ਮੈਨੂੰ ਸਰ ਬਸ ਇਹ ਹੀ ਬੇਨਤੀ ਹੈ ਕਿ ਉਹ ਆਡਰ ਵਾਪਸ ਹੋ ਜਾਵੇ ਅਤੇ ਉਹਦੀ ਲੋੜੀਂਦੇ ਜਿਹੜੇ ਪੈਸੇ ਬਣਦੇ ਆ ਸਰ ਉਹ ਮੈਨੂੰ ਦਿੱਤੇ ਜਾਣ ਤਾਂ ਕਿ ਉਹ ਖਾਣਾ ਕਿਸੇ ਹੋਰ ਨੂੰ ਅੱਗੇ ਪ੍ਰਦਾਨ ਕੀਤਾ ਜਾਵੇ ਕਿਉਂਕਿ ਜਿਹੜਾ ਖਾਣਾ ਉਹ ਮੇਰੇ ਕੋਲ ਵੇਸਟ ਹੀ ਜੋ ਹੋ ਜਾਣਾ ਸੀ ਠੀਕ ਹੈ ਸਰ ਥੈਂਕ ਯੂ